ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਸ ਵਿੱਚ ਪੁਰਾਤਨ ਖੇਡਾਂ ਵੀ ਜਿਹੜੀਆਂ ਵਾ ਸਾਡੀਆਂ ਖੇਡੀਆਂ ਜਾਂਦੀਆਂ ਹਨ ਜਿਸ ਨਾਲ ਸਰੀਰ ਦੀ ਵਰਜਿਸ਼ ਹੁੰਦੀ ਸੀ ਅਤੇ ਸਰੀਰ ਤੰਦਰੁਸਤ ਰਹਿੰਦੇ ਜਿਸ ਵਿੱਚ ਘੋਲ ਹੋਣੇ ਕਬੱਡੀ ਹੋਣੀ ਅੱਜ ਕੱਲ੍ਹ ਖੇਡਾਂ ਜਿਹੜੀਆਂ ਵਾ ਉਹ ਕ੍ਰਿਕਟ ਨੂੰ ਦੁਨੀਆ ਜ਼ਿਆਦਾ ਪਸੰਦ ਕਰਦੀ ਹੈ ਜਾਂ ਕ੍ਰਿਕਟ ਨੂੰ ਜ਼ਿਆਦਾ ਪਸੰਦ ਕਰਦੀ ਹੈ ਅਤੇ ਸਾਡੇ ਲੋਕ ਅੱਜ ਵੀ ਕਬੱਡੀ ਖੇਡਦੇ ਹਨ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੇ ਕਬੱਡੀ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਉਹ ਵਰਲਡ ਕੱਪ ਕਰਵਾਉਂਦੇ ਹਨ ਅਤੇ ਵਰਲਡ ਕੱਪ ਦੀਆਂ ਜੋ ਕਬੱਡੀ ਦੀਆਂ ਟੀਮਾਂ ਹਨ ਬਹੁਤ ਸੋਹਣਾ ਖੇਡਦੀਆਂ ਹਨ ਕਬੱਡੀ ਖੇਡਣ ਨਾਲ ਜਾਂ ਘੋਲ ਕਰਨ ਦੇ ਨਾਲ ਸਰੀਰ ਜਿਹੜੇ ਸੀ ਤੰਦਰੁਸਤ ਰਹਿੰਦੇ ਹੁੰਦੇ ਸੀ ਅਤੇ ਕਿਸੇ ਕਿਸਮ ਦਾ ਰੋਗ ਨਹੀਂ ਸੀ ਹੁੰਦਾ ਅੱਜ ਕੱਲ੍ਹ ਕ੍ਰਿਕਟ ਖੇਡਦੇ ਹਨ ਚੱਲੋ ਉਹ ਵੀ ਆਪਣੀ ਜਗ੍ਹਾ 'ਤੇ ਠੀਕ ਹੈ ਪਰ ਸਭ ਤੋਂ ਵਧੀਆ ਜਿਹੜੀ ਖੇਡ ਸਾਡੀ ਮਾਂ ਕਬੱਡੀ ਖੇਡ ਸੀ ਜੋ ਸਾਨੂੰ ਬਚਪਨ ਤੋਂ ਮਿਲੀ ਹੋਈ ਹੈ ਅਤੇ ਉਸ ਦੇ ਵਿੱਚ ਸਭ ਤੋਂ ਵਧੀਆ ਪਸੰਦ ਕੀਤੀ ਜਾਂਦੀ ਹੈ